ਜੇ ਖੇਡਾਂ ਖੇਡਦੇ ਹੋਏ ਕੋਈ ਖਿਡਾਰੀ ਜ਼ਖਮੀ ਹੋ ਜਾਂਦਾ ਹੈ ਤਾਂ ਉਸ ਉੱਥੇ ਮੌਜੂਦ ਡਾਕਟਰ ਜਿਹੜੇ ਕਿ ਸਹਾਇਤਾ ਲਈ ਮੌਜੂਦ ਹੁੰਦੇ ਆ ਪਹਿਲਾਂ ਹੀ ਉਹ ਜ਼ਖਮੀ ਖਿਡਾਰੀ ਨੂੰ ਸ ਮੁੱਢਲੀ ਸਹਾਇਤਾ ਦਿੰਦੇ ਆ ਉਸਦੇ ਜ਼ਖਮ 'ਤੇ ਮੱਲ੍ਹਮ ਪੱਟੀ ਕਰਦੇ ਹਾਂ ਉਸਦੇ ਜੇ ਕਿਸੇ ਦੀ ਹੱਡੀ ਟੁੱਟ ਜਾਂਦੀ ਹੈ ਤਾਂ ਉਸਦੇ ਪੁਆਇੰਟਾਂ ਨੂੰ ਨੱਪ ਕੇ ਜਾਂ ਜਿੱਦਾਂ ਵੀ ਹੈ ਕਰਕੇ ਉਹਦੀ ਮੱਲ੍ਹਮ ਪੱਟੀ ਕਰਕੇ ਉਹਨੂੰ ਉੱਥੇ ਮੁੱਢਲੀ ਸਹਾਇਤਾ ਦਿੱਤੀ ਜਾਂਦੀ ਹੈ ਜੇ ਕਿਸੇ ਕਾਰਨ ਕਾਰਨ ਜਖਮ ਖਿਡਾਰੀ ਜ਼ਿਆਦਾ ਜ਼ਖਮੀ ਹੋ ਜਾਂਦਾ ਹੈ ਤਾਂ ਫਿਰ ਉਸਨੂੰ ਉੱਥੇ ਮੁੱਢਲੀ ਸਹਾਇਤਾ ਦੇ ਕੇ ਉਹਦੀ ਮੱਲ੍ਹਮ ਪੱਟੀ ਕਰਕੇ ਉਸਨੂੰ ਐਬੂਲੈਂਸ ਦੇ ਵਿੱਚ ਹੋਸਪਿਟਲ ਲਿਜਾਇਆ ਜਾਂਦਾ ਹੈ ਜਿੱਥੇ ਉਸਦਾ ਸਰਕਾਰ ਦੇ ਵੱਲੋਂ ਫਰੀ ਇਲਾਜ ਕਰਵਾਇਆ ਜਾਂਦਾ ਹੈ ਜੇ ਉਹ ਖਿਡਾਰੀ ਅਪਾਹਜ ਹੋ ਜਾਂਦਾ ਹੈ ਤਾਂ ਉਸ ਖਿਡਾਰੀ ਨੂੰ ਉਸ ਖਿਡਾਰੀ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਅਤੇ ਉਸ ਖਿਡਾਰੀ ਨੂੰ ਫਿਰ ਨੌਕਰੀ ਦਿੱਤੀ ਜਾਂਦੀ ਹੈ ਤਾਂ ਕਿ ਉਸ ਦਾ ਆਰਥਿਕ ਪੱਖ ਜਿਹੜਾ ਹੈ ਉਹ ਠੀਕ ਰਹੇ ਅਤੇ ਉਹ ਆਪਣਾ ਘਰ ਦਾ ਗੁਜ਼ਾਰਾ ਚਲਾ ਸਕੇ ਇਹ ਸਾਡੇ ਖੇਡਾਂ ਵਾਲੇ ਲੋਕਾਂ ਲਈ ਇਲਾਜ ਦੀ ਪ੍ਰਕਿਰਿਆ ਹੈ